ਹੈਲੋ ਮੇਰਾ ਨਾਮ ਪਿੰਕੀ ਹੈ ਮੈਂ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹਾਂ ਅੱਜ ਕੱਲ੍ਹ ਲੋਕੀ ਖੂਹ ਵਿੱਚੋਂ ਪਾਣੀ ਇਸ ਤਰ੍ਹਾਂ ਕੱਢਦੇ ਹਨ ਕਿ ਬਾਲਟੀ ਵਗੈਰਾ ਬਾਲਟੀ ਵਗੈਰਾ ਬਾਲਟੀ ਵਗੈਰਾ ਨੂੰ ਰੱਸੀ ਬਾਲਟੀ ਨੂੰ ਰੱਸੀ ਰੱਸੀ ਨੂੰ ਰੱਸੀ ਬ ਰੱਸੀ ਬੰਨ ਕੇ ਬਾਲਟੀ ਨੂੰ ਖੂਹ ਵਿੱਚੋਂ ਪਾਣੀ ਕੱਢਦੇ ਹਨ

ਖੂਹ ਵਿੱਚੋਂ ਕੱਢਦੇ ਹਨ ਅੱਜ ਕੱਲ੍ਹ ਖੂਹ ਵਾਲਾ ਪਾਣੀ ਬਹੁਤ ਹੀ ਚੰਗਾ ਸਵੱਛ ਸਵੱਛ ਚੰਗਾ ਹੁੰਦਾ ਹੈ ਅਤੇ ਅਤੇ ਹੁਣ ਅੱਜ ਕੱਲ੍ਹ ਤਾਂ ਮਤਲਬ ਕਿ ਅੱਜ ਕੱਲ੍ਹ ਸਮਰਸੀਬਲ ਚੱਲ ਪਏ ਟੂਟੀਆਂ ਚੱਲ ਪਈਆਂ ਮੋਟਰ ਮੋਟਰ ਟੂਟੀਆਂ ਸਮਰਸੀਬਲ ਚੱਲ ਪਏ ਅਤੇ ਪਹਿਲੇ ਪਹਿਲੇ ਤਾਂ ਲੋਕੀ ਖੂਹ ਦਾ ਪਾਣੀ ਹੀ ਜ਼ਿਆਦਾ ਪੂਰਾ ਪਾਣੀ ਵਰਤਦੇ ਸਨ ਪਹਿਲੇ ਤਾਂ ਅਤੇ ਉਹ ਬਹੁਤ ਹੀ ਖੂਹ ਦਾ ਪਾਣੀ ਬੜਾ ਚੰਗਾ ਸਵੱਛ ਹੁੰਦਾ ਸੀ ਪਹਿਲਾਂ ਤਾਂ ਲੋਕਾਂ ਨੂੰ ਇਹ ਵਾਲੇ ਪਾਣੀ ਇਹ ਵਾਲੇ ਪਾਣੀ ਨਾਲ ਕੋਈ ਬਿਮਾਰੀ ਵਗੈਰਾ ਨਹੀਂ ਲੱਗਦੀ ਹੁਣ ਤਾਂ ਅੱਜ ਕੱਲ੍ਹ ਟੂਟੀਆਂ ਵਗੈਰਾ ਸਮਰਸੀਬਲ ਚੱਲ ਪਏ ਹਨ ਅਤੇ ਅੱਜ ਕੱਲ੍ਹ ਲੋਕੀ ਨੂੰ ਲੱਗ ਪਏ ਬਰਤਨ ਸਮਰਸੀਬਲ ਟੂਟੀਆਂ ਬਰਤਨ ਲੱਗ ਪਏ ਆ

ਖੂਹ ਦਾ ਪਾਣੀ ਬਹੁਤ ਹੀ ਸ਼ੁੱਧ ਪਾਣੀ ਹੈ ਸਾਫ ਸੁਥਰਾ ਆ ਪਾਣੀ ਚੰਗਾ ਪਾਣੀ ਹੈ ਵਧੀਆ ਇਹਨੂੰ ਲੋਕੀ ਪਹਿਲੇ ਬਹੁਤ ਪਸੰਦ ਕਰਦੇ ਸੀ ਮਟਕੇ ਭਰਦੇ ਹੁੰਦੇ ਸੀ ਪਹਿਲੇ ਲੋਕੀ ਕਿ ਮਟਕੇ ਵਗੈਰਾ ਵਾਟਰ ਕੂਲਰ ਖੂਹ ਦੇ ਪਾਣੀ ਦਾ ਭਰ ਭਰ ਕੇ ਭਰਦੇ ਸੀ ਅਤੇ ਹੁਣ ਤਾਂ ਅੱਜ ਕੱਲ੍ਹ ਟੂਟੀਆਂ ਵਗੈਰਾ ਸਾਰਾ ਕੁਛ ਚੱਲ ਪਿਆ ਅੱਜ ਕੱਲ੍ਹ ਲੋਕੀ ਖੂਹ ਦਾ ਪਾਣੀ ਵਰਤਦੇ ਨਹੀਂ ਪਸੰਦ ਹੀ ਨਹੀਂ ਕਰਦੇ ਹੁਣ ਟੂਟੀਆਂ ਦਾ ਪਾਣੀ ਵਰਤਣ ਲੱਗ ਪਏ ਐ ਲੋਕੀ ਅਤੇ ਤਾਂਹੀਓ ਜ਼ਿਆਦਾਤਰ ਲੋਕਾਂ ਨੂੰ ਬਿਮਾਰੀਆਂ ਚੱਲ ਪਈਆਂ ਪਹਿਲੇ ਖੂਹ ਦਾ ਪਾਣੀ ਵਧੀਆ ਹੁੰਦਾ ਸੀ ਸਾਰੇ ਵਰਤਦੇ ਸੀ ਖੂਹ ਦਾ ਪਾਣੀ ਅਤੇ ਪਹਿਲੇ ਲੋਕੀ ਹੈ ਵੀ ਤੰਦਰੁਸਤ ਸੀ ਹੁਣ ਲੋਕੀ ਪਾਣੀ ਵਰਤਣ ਲੱਗ ਪਏ ਹੈ ਦੂਜਾ ਸਮਰਸੀਬਲ ਬੋਰ ਕਰਵਾਉਂਦੇ ਆਪਣੇ ਘਰ ਉਹਦੇ ਨਾਲ ਜ਼ਿਆਦਾਤਰ ਲੋਕਾਂ ਨੂੰ ਬਿਮਾਰ ਬਿਮਾਰ ਹੋਣ ਲੱਗ ਪਏ ਲੋਕੀ ਪਹਿਲੇ ਖੂਹ ਦਾ ਪਾਣੀ ਵਧੀਆ ਸੀ ਅਤੇ ਲੋਕੀ ਤੰਦਰੁਸਤ ਸੀ ਅਤੇ ਹੁਣ ਲੋਕੀ ਦੂਜਾ ਸਮਰਸੀਬਲ ਦਾ ਪਾਣੀ ਟੂਟੀਆਂ ਦਾ ਵਰਤਨ ਲੱਗ ਗਏ ਅਤੇ ਓਨੇ ਜ਼ਿਆਦਾ ਲੋਕੀ ਹੁਣ ਬਿਮਾਰ ਪੈਣ ਲੱਗ ਪਏ ਹੈ ਇਸ ਕਰਕੇ ਇਹ ਪਾਣੀ ਬਹੁਤ ਹੀ ਚੰਗਾ ਹੈ ਖੂਹ ਦਾ ਪਾਣੀ ਇਹ ਵਧੀਆ ਹੈ ਖੂਹ ਦਾ ਪਾਣੀ ਅੱਜ ਕੱਲ੍ਹ ਜਿਹੜੇ ਲੋਕੀ ਘਰ ਆਪਣੇ ਘਰਾਂ ਵਿੱਚ ਬੋਰ ਕਰਵਾਉਣ ਲੱਗ ਪਏ ਆ ਇਹ ਪਾਣੀ ਨਹੀਂ ਹੈਗਾ ਲਾਭਦਾਇਕ ਖੂਹ ਦਾ ਪਾਣੀ ਵਧੀਆ ਸੀ ਇਸ ਕਰਕੇ ਸਾਨੂੰ ਜ਼ਿਆਦਾ ਖੂਹ ਦਾ ਪਾਣੀ ਹੀ ਪਹਿਲੇ ਵਧੀਆ ਲੱਗਦਾ ਸੀ ਅਤੇ ਸ਼ੁਧ ਪਾਣੀ ਹੁੰਦਾ ਸੀ ਖੂਹ ਦਾ ਆ ਤਾਂ ਹੁਣ ਪਾਣੀ ਚੱਲ ਪਿਆ ਦੂਸਰਾ ਬੋਰ ਵਗੈਰਾ ਸਾਰੇ ਲੋਕੀ ਨੂੰ ਇਹ ਲੱਗ ਪਏ ਵਰਤਣ ਤਾਂ ਹੀ ਜ਼ਿਆਦਾਤਰ ਲੋਕੀ ਬਿਮਾਰ ਪੈਣ ਲੱਗ ਪਏ ਆ ਟੁ ਖੂਹ ਦਾ ਪਾਣੀ ਵਧੀਆ ਸੀ ਪਹਿਲੇ ਲੋਕੀ ਖੂਹ ਤੋਂ ਪਾਣੀ ਭਰ ਭਰ ਕੇ ਲਿਆਂਦੇ ਹੁੰਦੇ ਸੀ ਬਾਲਟੀਆਂ ਵਗੈਰਾ ਬਾਲਟੀਆਂ ਵਗੈਰਾ ਨਾਲ ਕੱਢ ਕੱਢ ਕੇ ਖੂਹ ਦਾ ਪਾਣੀ ਵਰਤਦੇ ਹੁੰਦੇ ਸੀ ਹੁਣ ਲੋਕੀ ਅੱਜ ਕੱਲ੍ਹ ਚੱਲ ਲੋਕੀ ਹੁਣ ਲੱਗ ਪਏ ਆ ਟੂਟੀਆਂ ਟੂਟੀਆਂ ਦਾ ਪਾਣੀ ਪੀਣ ਹੁਣ ਇਸ ਕਰਕੇ ਕੋਈ ਖੂਹ ਦੇ ਪਾਣੀ ਵੱਲ ਕੋਈ ਦੇਖਦਾ ਨਹੀਂ ਹੁਣ ਪਹਿਲੇ ਲੋਕੀ ਚੰਗੇ ਸੀ ਤੰਦਰੁਸਤ ਸੀ ਖੂਹ ਦਾ ਪਾਣੀ ਪੀਂਦੇ ਸੀ ਅਤੇ ਹੁਣ ਤਾਂ ਲੋਕੀ ਤਾਂਹੀਓ ਬਿਮਾਰ ਪੈਣ ਲੱਗ ਪਏ ਆ